ਖੇਡਾਂ ਮਨੁੱਖ ਦੇ ਜੀਵਨ ਵਿੱਚ ਬਹੁਤ ਮਹੱਤਵ ਰੱਖਦੀਆਂ ਹਨ ਇਹ ਮਨੁੱਖ ਨੂੰ ਰੁਚੀ ਪ੍ਰਦਾਨ ਕਰਦੀਆਂ ਹਨ ਮਨੁੱਖ ਇੱਕ ਭਾਈਚਾਰੇ ਨਾਲ ਇੱਕ ਸਾਂਝ ਬਣਾ ਕੇ ਇੱਕ ਟੀਮ ਲਈ ਖੇਡਦੇ ਹਨ ਅਤੇ ਡਿਪਰੈਸ਼ਨ ਅਤੇ ਇੰਗਜ਼ਾਇਟੀ ਤੋਂ ਵੀ ਦੂਰ ਰਹਿੰਦੇ ਹਨ ਇਸ ਦੇ ਨਾਲ ਸਿਹਤ ਸਵੱਸਥ ਰਹਿੰਦੀ ਹੈ ਅਤੇ ਖੂਨ ਦਾ ਸੰਚਾਰ ਵੀ ਤੇਜ਼ ਹੁੰਦਾ ਹੈ